ਆਪਣੇ ਵਿਹਲੇ ਸਮੇਂ ਦੇ ਵਿੱਚ ਮੈਂ ਕਿਤਾਬ ਪੜ੍ਹਨ ਦੀ ਬਹੁਤ ਸ਼ੌਕੀਨ ਹਾਂ ਅਤੇ ਮੈਨੂੰ ਕਿਤਾਬ ਪੜ੍ਹਨਾ ਬਹੁਤ ਪਸੰਦ ਹੈ ਹਰੇਕ ਕਹਾਣੀ ਜਿਹੜੀ ਸਾਨੂੰ ਕੁਝ ਸਿੱਖਿਆ ਦੇ ਸਕਦੀ ਹੈ ਅਜਿਹੀ ਕਿਤਾਬ ਪੜ੍ਹਨਾ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਮੈਨੂੰ ਯਾਦ ਹੈ ਕੁਛ ਸਮੇਂ ਪਹਿਲਾਂ ਹੀ ਮੈਂ ਇੱਕ ਕਿਤਾਬ ਪੜ੍ਹੀ ਸੀ ਜਿਸਦਾ ਨਾਮ ਹੈ ਪੰਛੀਆਂ ਦੀ ਮਜਲਿਸ ਇਹ ਕਹਾਣੀ ਫਰੀਦ ਉਦ ਬਿਲ ਅਖਤਰ ਸਾਹਿਬ ਨੇ ਲਿਖੀ ਹੋਈ ਹੈ ਉਹ ਬਹੁਤ ਹੀ ਪ੍ਰਸਿੱਧ ਪੰਜਾਬੀ ਕਹਾਣੀਕਾਰ ਨੇ ਅਤੇ ਉਹਨਾਂ ਨੇ ਬਥੇਰੇ ਨਾਵਲ ਵੀ ਲਿਖੇ ਨੇ ਇਹ ਕਹਾਣੀ ਕੁਝ ਪੰਛੀਆਂ ਬਾਰੇ ਹੈ ਜਿਹੜੇ ਕਿ ਜੰਗਲ ਵਿੱਚ ਆਉਂਦੇ ਨੇ ਅਤੇ ਨਾਲ ਬਹਿ ਕੇ ਆਪਣਾ ਵਿਚਾਰ ਸਾਂਝੇ ਕਰਦੇ ਨੇ ਅਤੇ ਆਪਣੇ ਆਪਣੇ ਵਿਚਾਰਾਂ ਬਾਰੇ ਦੂਜੇ ਪੰਛੀਆਂ ਨੂੰ ਦੱਸਦੇ ਨੇ ਇਸ ਕਹਾਣੀ ਰਾਹੀਂ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਕੋਈ ਵੀ ਮਨੁੱਖ ਗਲਤ ਨਹੀਂ ਹੁੰਦਾ ਬਸ ਉਹਨਾਂ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਜਿਸ ਨਜ਼ੀਰੇ ਨਜ਼ਰੀਏ ਰਾਹੀਂ ਉਹ ਆਪਣੀ ਗੱਲ ਨੂੰ ਦੂਜੇ ਸਾਹਮਣੇ ਰੱਖਦੇ ਹਨ ਦੂਜੇ ਪਾਸੇ ਇਹ ਕਹਾਣੀਕਾਰ ਕਹਿਣਾ ਚਾਹੁੰਦਾ ਹੈ ਕਿ ਪੰਛੀਆਂ ਦੇ ਰੂਪਾਂ ਰਾਹੀਂ ਇਹ ਰਚਨਾ ਮਨੁੱਖ ਦੇ ਅੰਦਰ ਸੱਚ ਦੀ ਤਲਾਸ਼ ਨੂੰ ਦੱਸਦੀ ਹੈ ਇਸਦਾ ਰਜ਼ਮ ਭਰਪੂਰ ਚਿਹਨ ਸੰਸਾਰ ਵਾਸਤਵਿਕ ਕਰਦਾ ਹੈ ਕਹਾਣੀਕਾਰ ਦੀ ਇਹ ਕਹਾਣੀ ਬਹੁਤ ਹੀ ਗਹਿਰੀ ਅਤੇ ਡੂੰਘਾ ਪ੍ਰਭਾਵ ਪਾਉਂਦੀ ਹੈ ਪੜ੍ਹਨ ਵਾਲੇ 'ਤੇ ਅਤੇ ਇਹ ਕਹਾਣੀ ਮੈਨੂੰ ਬਹੁਤ ਪਸੰਦ ਆਈ ਅਤੇ ਇਹਦੇ ਨਾਲ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ